ਅਜਿਹੀਆਂ ਬਹੁਤ ਹੀ ਚੀਜ਼ਾਂ ਹਨ ਜੋ ਕਿ ਮੈਨੂੰ ਖੁਸ਼ੀ ਦਿੰਦੀਆਂ ਹਨ ਇਹਨਾਂ ਵਿੱਚੋਂ ਪਹਿਲੀ ਚੀਜ਼ ਸੈਰ ਹੈ ਮੈਂ ਸਵੇਰੇ ਉੱਠ ਕੇ ਸੈਰ ਕਰਦੀ ਹਾਂ ਜਿਸ ਤੋਂ ਬਾਅਦ ਮੈਂ ਬਹੁਤ ਹੀ ਜ਼ਿਆਦਾ ਫਰੈਸ਼ ਫੀਲ ਕਰਦੀ ਹਾਂ ਉਸ ਤੋਂ ਬਾਅਦ ਮੈਂ ਗੁਰਦੁਆਰੇ ਜਾਂਦੀ ਹਾਂ ਉੱਥੇ ਬੈਠ ਕੇ ਮੈਂ ਪਾਠ ਕਰਦੀ ਹਾਂ ਜਿਸ ਨਾਲ ਮੇਰੇ ਮਨ ਨੂੰ ਬਹੁਤ ਹੀ ਜ਼ਿਆਦਾ ਸ਼ਾਂਤੀ ਮਿਲਦੀ ਹੈ ਮੈਂ ਆਪਣੀ ਮੰਮ ਮੰਮੀ ਨਾਲ ਸਵੇਰ ਦਾ ਘਰ ਦਾ ਕੰਮ ਕਰਵਾਉਂਦੀ ਹਾਂ ਜਿਸ ਨਾਲ ਉਹਨਾਂ ਨੂੰ ਵੀ ਮਦਦ ਮਿਲ ਜਾਂਦੀ ਹੈ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਹੀ ਸ਼ੌਕ ਹੈ ਜਿਸ ਨਾਲ ਮੇਰੀ ਜਾਣਕਾਰੀ ਵੱਧ ਜਾਂਦੀ ਹੈ ਮੈਨੂੰ ਇਹ ਆਦਤ ਬਚਪਨ ਤੋਂ ਹੀ ਹੈ ਮੈਨੂੰ ਗਾਣਾ ਸੁਣਨੇ ਵੀ ਬਹੁਤ ਪਸੰਦ ਹਨ ਅਤੇ ਮੈਂ ਜ਼ਿਆਦਾਤਰ ਅਖਿਲ ਦੇ ਗਾਣੇ ਸੁਣਦੀ ਹਾਂ ਮੈਨੂੰ ਘੁੰਮਣਾ ਫਿਰਨਾ ਵੀ ਬਹੁਤ ਪਸੰਦ ਹੈ ਅਤੇ ਮੈਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਾਹਰ ਘੁੰਮਣ ਫਿਰਨ ਜਾਂਦੀ ਹਾਂ ਜਿਸ ਨਾਲ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਹੈ